ਹੈਲੋ ਹਾਂਜੀ ਨਮਸਕਾਰ ਜੀ

ਕਿਹੜਾ ਜੀ ਓਪੋ ਦਾ ਹੈਗਾ ਸੈਮਸੰਗ ਦਾ ਹੈਗਾ ਵੀਵੋ ਵੀ ਹੈਗਾ

ਹਾਂਜੀ ਬਾਰ੍ਹਾਂ ਹਜ਼ਾਰ ਤੋਂ ਜੀ

ਵਨ ਪਲੱਸ ਚੱਲ ਰਿਹਾ ਜ਼ਿਆਦਾ ਅੱਜ ਜੀ ਹਾਂ ਅਤੇ ਓਪੋ ਵੀ ਵਧੀਆ ਚੱਲ ਰਿਹਾ ਜੀ ਨਹੀਂ ਜੀ ਡਿਸਕਾਉਂਟ ਮਿਲੇਗਾ ਟੈਨ ਪਰਸੈਂਟ ਓ ਲਿਮਿਟਿਡ ਹੁੰਦਾ ਜੀ ਪਿੱਛੋਂ ਨਹੀਂ ਹੁਣ ਚੱਲ ਨਹੀਂ ਰਿਹਾ ਉੱਥੇ ਪਿੱਛੇ ਸੀਗਾ ਉਹ ਬੰਦ ਹੋ ਗਿਆ ਅਤੇ ਉਹ ਜਿੰਨਾ ਉਹਨਾਂ ਨੇ ਸਟੋਕ ਭੇਜਿਆ ਸੀ ਉਹ ਸਾਰਾ ਮਤਲਬ ਵਿੱਕ ਗਿਆ ਹਾਂਜੀ ਨਹੀਂ ਇਹਨਾਂ ਮੈਂ ਇਹਨਾਂ ਦੇ ਕੰਪਨੀ ਦੀ ਚੀਜ਼ਾਂ 'ਚ ਮਾਰਜਨ ਇੰਨਾ ਤਾਂ ਰਹਿੰਦਾ ਨਹੀਂ ਹੈਗਾ ਹਾਂਜੀ ਚਾਰਜਰ ਆਏਗਾ ਜੀ ਹੈੱਡਫੋਨ ਅਤੇ ਇੱਕ ਕਵਰ ਆਏਗਾ ਵਰੰਟੀ ਵਨ ਈਅਰ ਅੱਛਾ ਜੀ ਸਾਲ ਦੇ ਸਾਰੇ ਨਹੀਂ ਹਜੇ ਤਾਂ ਨਹੀਂ ਆਈ ਜੀ ਨਹੀਂ ਜੀ ਜਿਹਨੇ ਵੀ ਕਿਹਾ ਮਤਲਬ ਵਧੀਆ ਚੱਲਦੇ ਹੈ ਅਤੇ ਕੋਈ ਸ਼ਿਕਾਇਤ ਨਹੀਂ ਆਈ

ਉਹ ਤਾਂ ਅਸੀਂ ਟਾਈਮ ਦੇ ਹੁਣ ਪਹਿਲਾਂ ਪੰਦਰ੍ਹਾਂ ਦਿਨ ਹੁੰਦੇ ਹੈ ਨਾ ਜੀ ਪੰਦਰ੍ਹਾਂ ਦਿਨਾਂ 'ਚ ਜੇ ਕੋਈ ਦਿੱਕਤ ਆਵੇ ਤਾਂ ਪੀਸ ਬਦਲ ਕੇ ਦੇਨੇ ਹੈ ਹਾਂ ਪੰਦਰ੍ਹਾਂ ਦਿਨਾਂ ਦੇ ਵਿੱਚ ਵਿੱਚ ਜੇ ਕੋਈ ਵੀ ਦਿੱਕਤ ਆ ਜੇ ਉਸ ਤੋਂ ਬਾਅਦ ਜਿਹੜੇ ਮਤਲਬ ਹੈ ਕੋਈ ਦਿੱਕਤ ਆਵੇਗੀ ਮਹੀਨੇ ਬਾਅਦ ਡੇਢ ਮਹੀਨੇ ਦੋ ਮਹੀਨੇ ਬਾਅਦ ਕੋਈ ਦਿੱਕਤ ਆਵੇਗੀ ਤਾਂ ਉਹ ਫਿਰ ਰਿਪੇਅਰ ਕਰਵਾ ਕੇ ਦੇਣੀ ਜੀ ਹਾਂ ਉਹ ਕੰਪਨੀ ਦੇ ਹੱਥ ਹਾਂ ਕੰਪਨੀ ਕੋਲ ਭੇਜ ਦਈਦੇ ਆ ਉਹ ਫਿਰ ਤਿਆਰ ਕਰਕੇ ਵਾਪਸ ਭੇਜਦੇ ਠੀਕ ਹੈ ਜੀ